ਅਸੀਂ ਆਪਣੀ ਗਾਇਕੀ ਵਿੱਚ ਗਤੀਸ਼ੀਲਤਾ ਵਾਕੰਸ਼ ਅਤੇ ਵਿਆਖਿਆ ਨੂੰ ਸ਼ਾਮਲ ਕਰ ਸਕਦੇ ਹਾਂ ਸਾਨੂੰ ਵੇਖਣਾ ਚਾਹੀਦਾ ਹੈ ਕਿ ਸਾਡੇ ਗਾਣੇ ਸਾਡੀ ਗਾਣੇ ਦੀ ਗਤੀ ਬਹੁਤ ਹੀ ਜ਼ਿਆਦਾ ਤੇਜ਼ ਨਾ ਹੋਵੇ ਜਾਂ ਹੌਲੀ ਨਾ ਹੋਵੇ ਜਦੋਂ ਅਸੀਂ ਗਾਣਾ ਗਾਉਂਦੇ ਹਾਂ ਤਾਂ ਉਸਦੀ ਗਤੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੇਖਣਾ ਚਾਹੀਦਾ ਹੈ ਅਤੇ ਨਾਲ ਹੀ ਵੇਖਣਾ ਚਾਹੀਦਾ ਕਿ ਸਾਡਾ ਵਾਕੰਸ਼ ਸਹੀ ਤਰੀਕੇ ਨਾਲ ਜੁੜ ਰਿਹਾ ਹੈ ਅਤੇ ਅਸੀਂ ਜਿਸ ਚੀਜ਼ ਦੀ ਵਿਆਖਿਆ ਆਪਣੀ ਗਾਣੇ ਦੇ ਵਿੱਚ ਕਰਨੀ ਚਾਅ ਰਹੇ ਹਾਂ ਕੀ ਉਹ ਠੀਕ ਢੰਗ ਨਾਲ ਕੀਤੀ ਜਾ ਰਹੀ ਹੈ ਇਹ ਹੀ ਵੇਖਣਾ ਚਾਹੀਦਾ ਹੈ